ਹਾਂਜੀ ਹਾਂਜੀ ਹਾਂਜੀ ਦੱਸੋ ਮੈਮ ਅ ਠੀਕ ਹੈ ਜੀ

ਠੀਕ ਹੈ ਓਕੇ ਠੀਕ ਹੈ ਏਰੀਆ ਮੈਮ ਤੁਹਾਨੂੰ ਕਿੱਦਾਂ ਦਾ ਚਾਹੀਦਾ ਕੋਈ ਸਿਟੀ ਦਾ ਏਰੀਆ ਚਾਹੀਦਾ ਵਾ ਕਿ ਕੋਈ ਵਿਲੇਜ ਟਾਈਪ ਦਾ ਏਰੀਆ ਚਾਹੀਦਾ ਕਿੱਦਾਂ ਦਾ ਚਾਹੀਦਾ ਤੁਹਾਨੂੰ ਏਰੀਆ

ਓਕੇ ਅਤੇ ਸਾਡੀ ਨਾ ਇੱਥੇ ਇੱਕ ਕਲੋਨੀ ਹੈਗੀ ਆ ਸਾਡੇ ਸ਼ਿੰਗਾਰ ਐਵੇਨਿਊ ਕਲੋਨੀ ਆ ਉਹਦੇ ਵਿੱਚ ਤੁਹਾਨੂੰ ਮਿਲ ਜਾਏਗਾ ਉਹਦਾ ਵੀਹ ਫੁੱਟ ਦਾ ਮੱਥਾ ਆ ਘਰ ਦਾ ਅਤੇ ਸੱਠ ਫੁੱਟ ਦੀ ਲਾਮ ਹੈਗੀ ਆ ਉਹਦੇ ਵਿੱਚ ਤੁਹਾਡਾ ਕਿੰਨਾ ਵਧੀਆ ਹੋ ਜਾਏਗਾ ਥਰੀ ਬੈਡਰੂਮ ਹੋ ਜਾਣਗੇ ਦੋ ਵਾਸ਼ਰੂਮ ਹੋ ਜਾਣਗੇ ਇੱਕ ਡਾਇਨਿੰਗ ਰੂਮ ਹੋ ਜਾਏਗਾ ਅਤੇ ਇੱਕ ਇੱਕ ਅੱਧਾ ਛੋਟਾ ਮੋਟਾ ਲੋਨ ਵੀ ਤੁਹਾਨੂੰ ਮਿਲ ਜਾਏਗਾ ਅਤੇ ਬਜਟ ਕਿੰਨਾ ਕੁ ਆ ਤੁਹਾਡਾ ਅੱਸੀ ਲੱਖ ਦਾ ਬਜਟ ਆ ਤਾਂ ਅੱਸੀ 'ਚ ਮੈਮ ਥੋੜ੍ਹਾ ਔਖਾ ਹੋ ਜਾਣਾ ਵਾ ਥੋੜ੍ਹਾ ਜਿਹਾ ਤੁਹਾਨੂੰ ਵਧਾਉਣਾ ਪੈਣਾ ਵਾ ਕਿਉਂਕਿ ਜਿੱਦਾਂ ਦਾ ਤੁਸੀਂ ਏਰੀਆ ਮੰਗ ਰਹੇ ਜੇ ਨਾ ਉਸਦੀ ਡਿਮਾਂਡ ਕਾਫੀ ਹਾਈ ਆ ਫਿਰ ਵੀ ਅਸੀਂ ਤੁਹਾਨੂੰ ਸਸਤੇ ਰੇਟ 'ਤੇ ਦਵਾ ਦਾਂਗਾ ਫਿਰ ਵੀ ਮੇਰੀ ਹੈਗਾ ਵਾ ਐਸਟੀਮੇਟ ਕਿ ਮੈਨੂੰ ਨੱਬੇ ਲੱਖ ਤੋਂ ਲੈ ਕੇ ਇਕ ਕਰੋੜ ਦੇ ਵਿੱਚ ਵਿੱਚ ਤੁਹਾਨੂੰ ਮੈਂ ਦਵਾ ਸਕਦਾ ਉਹ ਕੋਈ ਗੱਲ ਨਹੀਂ ਈਸ਼ੂ ਮੈਮ ਮੈਂ ਤੁਹਾਨੂੰ ਲੋਨ ਵੀ ਕਰਵਾ ਦਾਂਗਾ ਸਾਡੇ ਕੋਂਟੈਕਟ ਕਾਫੀ ਨੇ ਤੁਹਾਨੂੰ ਲੋਨ ਕਰਵਾ ਦਾਂਗੇ ਅਸੀਂ ਲੋਨ ਦੀ ਕਿਸ਼ਤ ਤਾਂ ਮੈਮ ਤੁਸੀਂ ਆਪਣੀ ਮਰਜ਼ੀ ਨਾਲ ਕਰਵਾ ਸਕਦੇ ਜੇ ਇੱਕ ਸਾਲ ਲਈ ਦੋ ਸਾਲ ਲਈ ਤਿੰਨ ਸਾਲ ਲਈ ਚਾਰ ਸਾਲ ਲਈ ਜਿੰਨੀ ਤੁਸੀਂ ਚਾਹੋ ਅਤੇ ਤੁਸੀਂ ਮਿਨੀਮਮ ਡਾਊਨ ਪੇਮੈਂਟ ਕਰ ਸਕਦੇ ਜੇ ਫਿਫਟੀ ਲੱਖ ਦੀ ਵੀ ਕਰ ਸਕਦੇ ਜੇ ਉਸ ਤੋਂ ਥੋੜ੍ਹੀ ਜਿਹੀ ਉਤਾਂਹ ਕਰਨਾ ਜ਼ਿਆਦਾ ਤਾਂ ਵੀ ਕਰ ਸਕਦੇ ਜੀ ਠੀਕ ਹੈ ਤਾਂ ਅਗਰ ਜਦੋਂ ਵੀ ਤੁਸੀਂ ਇੰਟਰਸਟਿਡ ਹੋਵੋ ਅਤੇ ਵੇਖਣਾ ਚਾਹੋ ਪਲਾਟ ਵਗੈਰਾ ਤਾਂ ਸਾਡੇ ਆਫਿਸ ਆ ਜਿਓ ਅਤੇ ਮੈਂ ਤੁਹਾਨੂੰ ਦਿਖਾ ਦਾਂਗਾ

ਹਾਂਜੀ ਇਸ ਨੰਬਰ 'ਤੇ ਮੈਨੂੰ ਸੇਵ ਕਰ ਲਓ ਅਮਨ ਨਾਮ ਹੈ ਮੇਰਾ ਅ ਮੇਰਾ ਰਣਜੀਤ ਐਵੇਨਿਊ ਆਫਿਸ ਹੈਗਾ ਵਾ ਨਾਇਨ ਟੂ ਫਾਇਫ ਏ ਐੱਮ ਮੈਂ ਉੱਥੇ ਹੀ ਹੁੰਦਾ ਰਣਜੀਤ ਐਵੇਨਿਊ ਡੀ ਬਲੋਕ

ਓਕੇ ਥੈਂਕ ਯੂ ਮੈਮ